ਹੈਲੋ ਸਤਿ ਸ਼੍ਰੀ ਅਕਾਲ ਪ੍ਰਗਤੀ ਵਧੀਆ ਤੂੰ ਦੱਸ ਬਸ ਕੁਛ ਨਹੀਂ ਘਰਾਂ ਦੇ ਹੀ ਕੰਮ ਕਰਦੇ ਸੀਗੇ ਹੋਰ ਤੁਸੀਂ ਦੱਸੋ ਹਾਂਜੀ ਵਧੀਆ ਤੁਸੀਂ ਦੱਸੋ ਸਾਰੇ ਘਰਦੇ ਵਧੀਆ ਹਾਂਜੀ ਦੱਸੋ ਵਾਹ ਵਧਾਈਆਂ ਹੋਣ ਤੁਹਾਨੂੰ ਕਦੋਂ ਦਿੱਤਾ ਹਾਂਜੀ ਅੱਛਾ ਅੱਛਾ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਮਤਲਬ ਸ਼ਹਿਰਾਂ 'ਚ ਤਾਂ ਹੁੰਦੀਆਂ ਵੀ ਬਹੁਤ ਸੁਲਤਾਨ ਆ ਨਾਲੇ ਚੰਗੀ ਗੱਲ ਹੈ ਤੁਸੀਂ ਆ ਰਹੇ ਹੋ

ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਇਹ ਤਾਂ ਜਮਾ ਕਿਉਂਕਿ ਕਈ ਵਾਰ ਤਾਂ ਪਿੰਡਾਂ ਦੇ ਅੰਦਰ ਜਾਂਦੀਆਂ ਹੀ ਨਹੀਂ ਬੱਸਾਂ ਬਾਹਰੋਂ ਹੀ ਬਾਹਰ ਨਿਕਲ ਜਾਂਦੀਆਂ

ਚਲੋ ਵਧੀਆ ਗੱਲ ਆ ਹਾਂਜੀ ਕਾਫੀ ਹੈ ਬਹੁਤ ਸਹੂਲਤਾਂ ਹੈਗੀਆਂ ਇੱਥੇ ਤਾਂ ਜਿਵੇਂ ਅੱਦਲ ਸਕੂਲ ਸਕੂਲ ਵਗੈਰਾ ਵੀ ਜਿਵੇਂ ਹੈ ਨਾ ਵਧੀਆ ਟਾਈਮ 'ਤੇ ਬੰਦਾ ਪਹੁੰਚ ਜਾਂਦਾ ਤੁਹਾਨੂੰ ਪਤਾ ਸਵੇਰੇ ਸਵੇਰੇ ਕਿੰਨਾ ਉਹ ਭੱਜ ਦੌੜ ਦਾ ਟਾਈਮ ਹੁੰਦਾ ਅਤੇ ਇੱਧਰ ਤਾਂ ਵਧੀਆ ਹੋ ਜਾਂਦਾ ਇੱਧਰ ਮਤਲਬ ਜਿਵੇਂ ਹਸਪਤਾਲ ਵੀ ਨੇੜੇ ਨੇੜੇ ਹੈਗੇ ਆ ਅਤੇ ਹੋਰ ਵੀ ਮਤਲਬ ਸਭ ਕੁਛ ਇੱਥੋਂ ਦਾ ਬਹੁਤ ਕੁਛ ਹੈਗਾ ਇੱਥੇ ਇੱਧਰ ਦੀਆਂ ਆਪਣਾ ਪਿੰਡਾਂ 'ਚ ਤਾਂ ਕਈ ਕਈ ਵਾਰ ਪਾਣੀ ਵੀ ਨਹੀਂ ਆਉਂਦਾ ਹੁੰਦਾ ਇੱਥੇ ਤਾਂ ਸਾਡੇ ਘਰਾਂ 'ਚ ਵੀ ਪਾਣੀ ਆ ਜਾਂਦਾ ਹੈ ਨਾ ਵਾਟਰ ਸਪਲਾਈ ਵਗੈਰੀਆਂ ਵੀ ਹੈਗੀਆਂ ਇੱਥੇ ਕਾਫੀ ਪਰ ਇੱਕ ਗੱਲ ਹੈ ਕਿ ਪਿੰਡਾਂ 'ਚ ਸਬਜ਼ੀਆਂ ਤਾਜ਼ੀਆਂ ਮਿਲਦੀਆਂ ਹੈ ਨਾ ਅੱਛਾ ਚਲੋ ਵਧੀਆ ਹਾਂ ਹਾਂ ਬਿਲਕੁਲ ਸਹੀ ਗੱਲ ਹੈ ਬਹੁਤ ਵਧੀਆ ਪੜ੍ਹਾਈ ਕਰਵਾਈ ਜਾਂਦੀ ਹੈ ਇੱਥੇ ਤਾਂ ਪੂਰਾ ਸਿਸਟਮ ਨਾਲ ਪੂਰਾ ਮਤਲਬ ਹੁੰਦਾ ਕਿ ਚੰਗੀ ਤਰ੍ਹਾਂ ਹੈ ਨਾ ਪਤਾ ਹੀ ਹੈ ਜਿਵੇਂ ਪਿੰਡਾਂ 'ਚ ਐਦਾਂ ਜਿਵੇਂ ਸਰਕਾਰੀ ਸਕੂਲਾਂ 'ਚ ਕਰਵਾਉਂਦੇ ਪੜ੍ਹਾਈਆਂ ਉਹ ਵਾਲਾ ਸਿਸਟਮ ਨਹੀਂ ਹੈਗਾ ਇੱਥੇ ਸ਼ਹਿਰਾਂ ਦੇ ਤਾਂ ਬਹੁਤ ਵਧੀਆ ਕਰਵਾਉਂਦੇ ਚੰਗੀ ਤਰ੍ਹਾਂ ਪ੍ਰੋਪਰ ਟਾਈਮ ਟੂ ਟਾਈਮ ਜਾਣਾ ਅਤੇ ਬਹੁਤ ਮਤਲਬ ਕਿ ਐਕਟੀਵਿਟੀਜ਼ ਵੀ ਕਰਵਾਉਂਦੇ ਆ ਸਕੂਲੇ ਬੱਚਾ ਸਿਰਫ ਪੜ੍ਹਾਈ ਵਿੱਚ ਹੀ ਨਹੀਂ ਕਿ ਹੋਰਾਂ ਵਿੱਚ ਵੀ ਉਹ ਹੋਵੇ ਅੱਗੇ ਵਧੇ ਹਾਂ ਹਾਂ ਹਾਂ ਬਿਲਕੁਲ ਸਹੀ ਗੱਲ ਆ ਹੋਰ ਉੱਥੇ ਥੋੜ੍ਹਾ ਸਕੂਲ ਕਰਕੇ ਹੀ ਨਹੀਂ ਹੋਰ ਵੀ ਬਹੁਤ ਜਿਵੇਂ ਹੈਗੀਆਂ ਸਹੂਲਤਾਂ ਮਤਲਬ ਇੱਧਰ ਦੀਆਂ ਤੁਹਾਨੂੰ ਪਤਾ ਹੀ ਪਿੰਡਾਂ 'ਚ ਰਾਤੀਂ ਨਹੀਂ ਆਇਆ ਜਾਂਦਾ ਹਸਪਤਾਲ ਲੱਭਣੇ ਪੈਂਦੇ ਆ ਜਦੋਂ ਬਿਮਾਰ ਹੋ ਜਾਵੇ ਹੈ ਨਾ ਇੱਥੇ ਟਾਈਮ ਟੂ ਟਾਈਮ ਬੰਦਾ ਚਲ ਟਾਈਮ ਟੂ ਟਾਈਮ ਬੰਦਾ ਚਲ ਜਾਂਦਾ ਹਸਪਤਾਲਾਂ 'ਚ

ਹਾਂ ਹਾਂ ਬਿਲਕੁਲ ਸਹੀ ਹੈਗਾ ਕੋਈ ਹਾਂ ਇੱਦਾਂ ਵੀ ਹੁੰਦਾ ਸ਼ਹਿਰਾਂ ਵਿਚ ਆ ਜਾਂਦੇ ਆ ਬਹੁਤ ਵਧੀਆ ਗੱਲ ਹੈ ਤੁਸੀਂ ਆ ਰਹੇ ਹੋ ਸ਼ਹਿਰ ਬਹੁਤ ਸਹੂਲਤਾਂ ਹੈਗੀਆਂ ਇੱਥੇ ਤਾਂ ਹੋਰ ਹੋਰ ਦੱਸੋ